ਹਾਂਜੀ ਸਾਡੀ ਰੋਜ਼ੀ ਰੋਟੀ ਬਿਜਲੀ 'ਤੇ ਨਿਰਭਰ ਕਰਦੀ ਹੈ ਮੈਂ ਇੱਕ ਕੰਪਿਊਟਰ ਸੈਂਟਰ 'ਤੇ ਕੰਮ ਕਰਦੀ ਹਾਂ ਇਹ ਕੰਮ ਤਾਂ ਪੂਰੀ ਤਰ੍ਹਾਂ ਬਿਜਲੀ 'ਤੇ ਨਿਰਭਰ ਕਰਦਾ ਹੈ ਇਸ ਕੰਮ ਨੂੰ ਪੂਰਾ ਕਰਨ ਲਈ ਬਿਜਲੀ ਦੀ ਹਰ ਪੱਖ ਤੋਂ ਜ਼ਰੂਰਤ ਹੈ ਦੇਖਿਆ ਜਾਵੇ ਤਾਂ ਆਮ ਜੀਵਨ ਵਿੱਚ ਅੱਜ ਕੱਲ੍ਹ ਕਿੰਨੇ ਅਜਿਹੇ ਕੰਮ ਹਨ ਜੋ ਬਿਜਲੀ ਕਰਕੇ ਹੀ ਪੂਰੇ ਹੋ ਹੁੰਦੇ ਹਨ ਪਰ ਜਦ ਬਿਜਲੀ ਦੇ ਕੱਟ ਲੱਗਦੇ ਹਨ ਤਾਂ ਇਹ ਕੰਮ ਕਰਨੇ ਅਸੰਭਵ ਹੋ ਜਾਂਦੇ ਹਨ ਮੇਰਾ ਕੰਮ ਤਾਂ ਹਰ ਪੱਖ ਤੋਂ ਬਿਜਲੀ 'ਤੇ ਨਿਰਭਰ ਕਰਦਾ ਹੈ ਬਿਜਲੀ ਤੋਂ ਬਿਨ੍ਹਾਂ ਤਾਂ ਅਸੀਂ ਆਪਣਾ ਕੰਪਿਊਟਰ ਚਲਾ ਵੀ ਨਹੀਂ ਪਾਉਂਦੇ ਜਿਸ ਨਾਲ ਮੇਰੇ ਕੰਮ ਦਾ ਬਹੁਤ ਨੁਕਸਾਨ ਹੁੰਦਾ ਹੈ ਇਸ ਨੁਕਸਾਨ ਤੋਂ ਬਚਣ ਲਈ ਸਾਨੂੰ ਜਨਰੇਟਰ ਜਾਂ ਇਨਵਰਟਰ ਦੀ ਮਦਦ ਲੈਣੀ ਪੈਂਦੀ ਹੈ ਪਰ ਜਨਰੇਟਰ ਦਾ ਖਰਚਾ ਬਿਜਲੀ ਦੇ ਕੱਟਾਂ ਕਰਕੇ ਇ ਇੰਨਾ ਜ਼ਿਆਦਾ ਹੋ ਜਾਂਦਾ ਕਿ ਲੱਗਦਾ ਹੈ ਕਿ ਕਮਾਈ ਵਿੱਚ ਫਾਲਤੂ ਵਿੱਚ ਹੀ ਘਾਟਾ ਖਾ ਰਹੀ ਹਾਂ ਪਰ ਕੱਟ ਦੇ ਦੌਰਾਨ ਇਹ ਖਰਚਾ ਪੂਰਾ ਕਰਨਾ ਲਾਜ਼ਮੀ ਹੁੰਦਾ ਹੈ ਪਰ ਬਿਜਲੀ ਦੇ ਕੱਟ ਸਮੇਂ ਛੋਟੇ ਕੰਮਾਂ ਵਾਲਿਆਂ ਦਾ ਤਾਂ ਬਹੁਤ ਨੁਕਸਾਨ ਹੁੰਦਾ ਗਰਮੀ ਵਿੱਚ ਤਾਂ ਘਰਾਂ ਵਿੱਚ ਬੈਠੇ ਲੋਕਾਂ ਦਾ ਬਹੁਤ ਬੁਰਾ ਹਾਲ ਹੋ ਜਾਂਦਾ ਕਿਉਂਕਿ ਅੱਜ ਵੀ ਸਾਡੇ ਸਮਾਜ ਵਿੱਚ ਇਹੋ ਜਿਹੇ ਲੋਕ ਹਨ ਜੋ ਘੱਟ ਆਮਦਨੀ ਕਰਕੇ ਆਪਣੇ ਘਰਾਂ ਵਿੱਚ ਇਨਵਰਟਰ ਵੀ ਨਹੀਂ ਲਗਾ ਸਕਦੇ ਤਕਨੀਕ ਨੇ ਜੋ ਵੀ ਸਹੂਲਤ ਸਾਨੂੰ ਦਿੱਤੀ ਹੈ ਉਹ ਆਪਣੀ ਗਰੀਬੀ ਕਰਕੇ ਉਸ ਦਾ ਲਾਭ ਲੈਣ ਤੋਂ ਵੀ ਵਾਂਝੇ ਰਹਿ ਜਾਂਦੇ ਹਨ